ਫਤਿਹਗੜ੍ਹ ਸਾਹਿਬ ਹਰ ਸਾਲ ਦਸੰਬਰ ਦੇ ਮਹੀਨੇ ਵਿੱਚ ਸ਼ਹੀਦੀ ਜੋੜ ਮੇਲਾ ਲੱਗਦਾ ਹੈ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਹਨ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਯਾਦ ਵਿੱਚ ਛੱਬੀ ਸਤਾਈ ਅਠਾਈ ਨੂੰ ਫਤਿਹਗੜ੍ਹ ਸਾਹਿਬ ਵਿਖੇ ਪੰਜਾਬ ਵਿੱਚ ਲੱਗਦਾ ਹੈ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੇ ਨੇ ਕੈਦ ਕਰ ਲਏ ਸਨ ਉਸ ਨੇ ਉਹਨਾਂ ਨੂੰ ਖਜ਼ਾਨਿਆਂ ਦੀ ਸੁਖਾਲੀ ਜ਼ਿੰਦਗੀ ਦੀ ਪੇਸ਼ਕਸ਼ ਕੀਤੀ ਜੇ ਉਹ ਇਸਲਾਮ ਨੂੰ ਕਬੂਲ ਕਰ ਲੈਂਦੇ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਅਤੇ ਸਿੱਖ ਧਰਮ ਵਿੱਚ ਆਪਣੀ ਨਿਸ਼ਚਾ 'ਤੇ ਡਟੇ ਰਹੇ ਉਹ ਇੱਕ ਕੰਧ ਵਿੱਚ ਜਿੰਦਾ ਚਿਣ ਦਿੱਤੇ ਗਏ ਸਨ ਪਰ ਕੰਧ ਡਿੱਗ ਪਈ ਸੀ ਛੱਬੀ ਦਸੰਬਰ ਸਤਾਰ੍ਹਾਂ ਸੌ ਪੰਜ ਨੂੰ ਸਰਹੰਦ ਵਿਖੇ ਕਤਲ ਕਰ ਦਿੱਤਾ ਗਿਆ ਸੀ ਸਰਹੰਦ ਤੋਂ ਪੰਜ ਕਿਲੋਮੀਟਰ ਉੱਤਰ ਵੱਲ ਗੁਰਦੁਆਰਾ ਫਤਹਿਗੜ੍ਹ ਸਾਹਿਬ ਉਸ ਕਤਲਗਾਹ ਦੀ ਨਿਸ਼ਾਨੀ ਹੈ ਅਤੇ ਉਸ ਤੋਂ ਉਪਰੰਤ ਨਾਲੇ ਗੁਰਦੁਆਰਾ ਠੰਢਾ ਬੁਰਜ ਸਾਹਿਬ ਪੈਂਦਾ ਹੈ ਜਿੱਥੇ ਮਾਤਾ ਗੁਜਰੀ ਜੀ ਦੇ ਨਾਲ ਦੋਨੋਂ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ ਅਤੇ ਬੈਕ ਸਾਇਡ 'ਤੇ ਗੁਰਦੁਆਰਾ ਵੀਵਾਨਗੜ੍ਹ ਸਾਹਿਬ ਹੈ ਜਿੱਥੇ ਤਿੰਨ ਦਿਨ ਸ਼ੇਰ ਨੇ ਇਹਨਾਂ ਦੀ ਰਾਖੀ ਕਰੀ ਸੀ ਉਸ ਤੋਂ ਬਾਅਦ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਸ਼ਹੀਦੀ ਵਾਸਤੇ ਸੰਸਕਾਰ ਵਾਸਤੇ ਦੀਵਾਨ ਟੋਡਰਮੱਲ ਜੀ ਨੇ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਅੰਤਿਮ ਸੰਸਕਾਰ ਵਾਸਤੇ ਜਮੀਨ ਖਰੀਦੀ ਸੀ ਅਤੇ ਸੰਸਾਰ ਦੀ ਇਹ ਸਭ ਤੋਂ ਮਹਿੰਗੀ ਜਮੀਨ ਹੈ ਇੱਥੇ ਵੱਖ ਵੱਖ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਲੋਕ ਸ਼ਹੀਦੀ ਜੋੜ ਮੇਲੇ ਸਮੇਂ ਦਰਸ਼ਨਾਂ ਵਾਸਤੇ ਆਉਂਦੇ ਹਨ ਅਤੇ ਨੇੜੇ ਤੇੜੇ ਦੇ ਅਤੇ ਹਰਿਆਣਾ ਦੇ ਪੰਜਾਬ ਦੇ ਹੋਰ ਜਿਲ੍ਹਿਆਂ ਦੇ ਕਈ ਪਿੰਡਾਂ ਵਾਲੇ ਆ ਕੇ ਲੰਗਰ ਲਾਉਂਦੇ ਹਨ ਜਿਸ ਨਾਲ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਛੋਟੇ ਸਾਹਿਬਜ਼ਾਦਿਆਂ ਨੇ ਸਿੱਖਾਂ ਦੇ ਬੱਚਿਆਂ ਨੂੰ ਪ੍ਰੇਰਨਾ ਦਾ ਸਰੋਤ ਨੇ ਇਹ ਅੱਜ ਕੱਲ੍ਹ ਬੱਚੇ ਜੋ ਕਿ ਸਿੱਖੀ ਤੋਂ ਦੂਰ ਜਾ ਰਹੇ ਹਨ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਪੁਲਿਸ ਦੀ ਬਹੁਤ ਵਧੀਆ ਵਿਵਸਥਾ ਹੁੰਦੀ ਹੈ ਪੁਲਿਸ ਵਧੀਆ ਕੰਟਰੋਲ ਕਰਦੀ ਹੈ ਆਲੇ ਦੁਆਲੇ ਅਤੇ ਟਰੈਫਿਕ ਰੋਕਿਆ ਹੁੰਦਾ ਜਿਹਦੇ ਨਾਲ ਵੀ ਆਈ ਹੋਈ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕੋਲਿਜ ਵੱਲੋਂ ਕੋਲਿਜ ਦੇ ਗੇਟ 'ਤੇ ਦਸਤਾਰ ਮੁਕਾਬਲੇ ਕਰਾਏ ਜਾਂਦੇ ਹਨ ਅਤੇ ਲੰਗਰ ਵੀ ਤਿੰਨ ਦਿਨ ਲਾਇਆ ਜਾਂਦਾ ਹੈ ਅਤੇ ਆਈ ਗਈ ਸੰਗਤ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਨੇੜੇ ਤੇੜੇ ਕਈ ਜਗ੍ਹਾ ਛੋਟੇ ਸਾਹਿਬਜ਼ਾਦਿਆਂ ਬਾਰੇ ਮੂਵੀ ਨਾਲ ਬੱਚਿਆਂ ਨੂੰ ਨੌਲੇਜ ਦਿੱਤੀ ਜਾਂਦੀ ਹੈ ਬਈ ਉਸ ਸਮੇਂ ਦੇ ਹਾਲਾਤਾਂ ਨਾਲ ਜਾਣੂ ਕਰਾਇਆ ਜਾਂਦਾ ਹੈ